ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਜੀ ਸਰ ਦੇਖੋ ਫਿਲਹਾਲ ਪੰਜਾਬ ਦਾ ਐਜੂਕੇਸ਼ਨ ਸਿਸਟਮ ਬੜਾ ਸਟੇਅ ਚੱਲਣ ਡਿਆ ਫਿਲ ਜਿੱਦਾਂ ਕਿ ਆਪਣੇ ਟੀਚਰ ਟਾਈਮ ਟੂ ਟਾਈਮ ਪੜਾਉਂਦੇ ਆ ਰੈਗੂਲੇਟਰੀ ਪੰਜਾਬੀ ਸਕੂਲ ਇੰਗਲਿਸ਼ ਮੀਡੀਅਮ 'ਚ ਉਹਨਾਂ ਨੇ ਕਰਤੇ ਆ ਅਤੇ ਸਕੂਲ 'ਚ ਲਾਈਬ੍ਰੇਰੀਆਂ ਵੀ ਹੈਗੀਆਂ ਅਤੇ ਹੋਰ ਵੀ ਵਧੀਆ ਚੱਲਣ ਡਿਆ ਫਿਲਹਾਲ

ਨਹੀਂ ਨਹੀਂ ਸਰ ਉਹ ਪਹਿਲਾਂ ਵੀ ਮਿਲਦੀਆਂ ਹੈਗੀਆਂ ਹੁਣ ਵੀ ਮਿਲਦੀਆਂ ਹੁਣ ਹਾਲਾਂਕਿ ਪਹਿਲਾਂ ਨਾਲੋਂ ਵੱਧ ਗਈਆਂ ਜਿੱਦਾਂ ਕਿ ਸਰਕਾਰੀ ਸਕੂਲਾਂ 'ਚ ਲਾਈਬਰੇਰੀਆਂ ਹੋ ਗਈਆਂ ਬੁੱਕਾਂ ਸਕੂਲ ਵੱਲੋਂ ਮਿਲਦੀਆਂ ਫੀਸਾਂ ਮੁਆਫ ਹੈ ਦੁਪਹਿਰ ਦਾ ਖਾਣਾ ਸਕੂਲਾਂ ਦਾ ਉੱਥੇ ਮਿਲਦਾ ਬੱਚੇ ਪਹਿਲਾਂ ਨਾਲੋਂ ਵਰਦੀਆਂ ਯੂਨੀਫਾਰਮ 'ਚ ਸਾਰੇ ਰੈਗੂਲਰ ਆਉਂਦੇ ਆ ਨਾਲ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਟਾਟ ਹੁੰਦੇ ਸੀ ਹੁਣ ਡੈਕਸ ਡੈਸਕ ਹੋ ਗਏ ਆ ਬੱਚੇ ਬੈਂਚ 'ਤੇ ਬੈਠਦੇ ਹੈ ਵਧੀਆ ਚੱਲਣ ਡਿਆ ਹੁਣ ਪਹਿਲਾਂ ਨਾਲੋਂ ਹਾਂਜੀ ਹਾਂਜੀ ਹਾਂਜੀ ਦੇਖੋ ਪ੍ਰਾਈਵੇਟ ਦੇ ਵਿੱਚ ਜਿਹੜੀਆਂ ਫੀਸਾਂ ਜ਼ਿਆਦਾ ਕੁਝ ਬੱਚੇ ਉੱਥੇ ਅਫੋਰਡ ਨਹੀਂ ਕਰ ਸਕਦੇ ਸਰਕਾਰੀ 'ਚ ਫੀਸਾਂ ਘੱਟ ਆ ਨਾਲ ਸਰਕਾਰੀ ਹੁਣ ਇੰਗਲਿਸ਼ ਮੀਡੀਅਮ 'ਚ ਵੀ ਆ ਗਏ ਆ ਪਹਿਲਾਂ ਲੋਕ ਪ੍ਰਾਈਵੇਟ ਤਾਂ ਜਾਂਦੇ ਸੀ ਵੀ ਉੱਥੇ ਇੰਗਲਿਸ਼ ਮੀਡੀਅਮ ਹੁੰਦਾ ਸੀ ਹੁਣ ਲੋਕ ਪ੍ਰਾਈ ਪ੍ਰਾਈਵੇਟ ਜਾਣ ਤੋਂ ਇਲਾਵਾ ਸਰਕਾਰੀ 'ਚ ਜਾਂਦੇ ਆ ਉੱਥੇ ਇੰਗਲਿਸ਼ ਮੀਡੀਅਮ ਆਲਰੇਡੀ ਆ ਚੁੱਕਿਆ ਨਾਲ ਫੀਸਾਂ ਦਾ ਵੀ ਜਿਹੜਾ ਬੜਾ ਫ਼ਰਕ ਹੈ ਅਤੇ ਦੁਪਹਿਰ ਦਾ ਖਾਣਾ ਜਿਹੜਾ ਉਹ ਸਰਕਾਰੀ ਸਕੂਲ 'ਚ ਦਿੱਤਾ ਜਾਂਦਾ ਅਤੇ ਟੀਚਰ ਵੀ ਹਰ ਇੱਕ ਸਬਜੈਕਟ ਦਾ ਇੱਕ ਇੱਕ ਟੀਚਰ ਹੈਗਾ ਹਰ ਇੱਕ ਸਬਜੈਕਟ ਨਹੀਂ ਦੇਖੋ ਟਰਾਂ ਟਰਾਂਸਪੋਰਟ ਦਾ ਕੋਈ ਪ੍ਰਬੰਧ ਨਹੀਂ ਹੈਗਾ ਬੱਚਿਆਂ ਦਾ ਖੁਦ ਆਪਣਾ ਪ੍ਰਾਈਵੇਟ ਵਹੀਕਲ ਜਿਹੜਾ ਅਰੇਂਜ ਕਰਨੇ ਪੈਂਦਾ